ਹੈਲੋ ਹਾਂਜੀ ਹਾਂਜੀ ਬੋਲੋ ਅੱਛਾ ਕਿਹੜੀ ਕਰਵਾਣੀ ਸੀ ਅੱਛਾ ਅੱਛਾ ਸਲਿਪਰ ਕਰਵਾਉਣੀ ਐ ਕਿਸ ਟਾਈਮਿੰਗ ਤੁਹਾਨੂੰ ਚਾਹੀਦੀ ਐ ਟਿਕਟ ਵੈਸੇ ਸੂਬਾ ਤੇ ਟਾਈਮ ਦੀ ਦੁਪਹਿਰ ਦੀ ਜਾ ਰਾਤ ਦੀ ਅੱਛਾ ਰਾਤ ਚਾਹੀਦੀ ਐ ਰਾਤੀ ਇੱਕ ਬੱਸ ਤਾਂ ਜਾਂਦੀ ਏ ਨੌਂ ਵਜੇ ਦੱਸ ਵਜੇ ਵੀ ਜਾਂਦੀ ਏ ਮਤਲਬ ਇੱਕ ਇੱਕ ਘੰਟੇ ਦਾ ਗੈਪ ਹੈਗਾ ਜੀ ਚੇਅਰ ਵਾਲੀ ਤੁਸੀਂ ਲੈਂਦੇ ਹੋ ਤਾਂ ਉਹ ਅੱਠ ਸੌ ਤੇ ਪੈਂਦੀ ਐ ਜੇ ਤੁਸੀਂ ਸਲਿੱਪਰ ਲੈਣੀ ਐ ਤਾਂ ਉਹਦਾ ਰੇਟ ਬਾਰਾਂ ਸੌ ਰੁਪਏ ਐ ਇੱਕ ਜਣੇ ਦਾ ਹਾਂਜੀ ਕਿੰਨੇ ਜਾਣੇ ਹੋ ਤੁਸੀਂ ਅੱਛਾ ਟਾਈਮ ਤੁਹਾਨੂੰ ਲੱਗ ਜੂਗਾ ਚਾਰ ਕੁ ਘੰਟੇ ਚਾਰ ਪੰਜ ਘੰਟੇ ਜਿਵੇਂ ਜੇ ਇਥੋਂ ਤੁਸੀਂ ਨੌਂ ਵਜੇ ਚੱਲੋ ਤਾਂ ਰਾਤੀ ਦੋ ਢਾਈ ਵਜੇ ਉਥੇ ਪਹੁੰਚ ਜਾਓਗੇ ਹਾਂਜੀ ਸਲਿੱਪਰ ਦੇ ਵਿੱਚ ਤੁਹਾਨੂੰ ਇੱਕ ਟਾਈਮ ਦਾ ਖਾਣਾ ਵੀ ਮਿਲੇਗਾ ਜੇ ਤੁਸੀਂ ਰਾਤ ਵੀ ਲੈਂਦੇ ਹੋ ਤਾਂ ਰਾਤ ਦਾ ਡਿਨਰ ਵੀ ਹੋਏਗਾ ਵਿੱਚ ਜੇ ਤੁਸੀਂ ਸਵੇਰੇ ਦੀ ਟਿਕਟ ਕਰਵਾਉਂਦੇ ਹੋ ਤਾਂ ਉਹਦੇ ਵਿੱਚ ਸਾਨੂੰ ਬ੍ਰੇਕਫਾਸਟ ਮਿਲੇਗਾ ਹਾਂਜੀ ਜੇ ਦੁਪਹਿਰ ਦੀ ਕਰਵਾਉਂਦੇ ਹੋ ਤਾਂ ਵਿੱਚ ਲੰਚ ਮਿਲੇਗਾ ਹਾਂਜੀ ਹਾਂਜੀ ਉਹਦੇ ਵਿੱਚ ਹਾਂਜੀ ਸਰਦੀਆਂ ਵਿੱਚ ਤੁਹਾਨੂੰ ਹਿਟਰਸ ਦੀ ਅਵੇਲੇਬਿਲਟੀ ਹੁੰਦੀ ਐ ਤੇ ਗਰਮੀਆਂ ਵਿੱਚ ਏਸੀ ਵੀ ਹੁੰਦੀ ਹੈ ਹਾਂਜੀ ਇਸ ਤਰ੍ਹਾਂ ਦੋ ਤਿੰਨ ਨਵੀਆਂ ਵੀ ਚਲੀਆਂ ਨੇ ਬਸਿਸ ਹੋਰ ਅਭਿਮਨਿਊ ਤੇ ਚੱਲੀ ਐ ਵਿਨੋਦ ਦੀ ਵੀ ਹਾਂਜੀ ਤੁਹਾਨੂੰ ਅਭਿਮਨਿਊ ਵਾਲੀ ਬੱਸ ਮਿਲ ਜਾਏਗੀ ਟਿਕਟ ਵਿਨੋਦ ਵਾਲੀ ਤਾਂ ਫੁੱਲ ਹੋ ਚੁੱਕੀ ਐ ਹਾਂਜੀ ਉਹ ਫਿਰ ਰਾਤੀ ਲੇਟ ਜਾਂਦੀ ਏ ਬਾਰਾਂ ਕੁ ਵਜੇ

ਉਹਦਾ ਵਿਨੋਦ ਵਾਲੀ ਤਾਂ ਜਿਵੇਂ ਹੁਣ ਨਵੀਂ ਚੱਲੀਏ ਏ ਨਾ ਉਹਦਾ ਤੁਹਾਨੂੰ ਚੇਅਰ ਵਾਲੀ ਦਾ ਬਾਰਾਂ ਸੌ ਪਏਗਾ ਇਹਦੇ ਚ ਤਾਂ ਸਲਿੱਪਰ ਦਾ ਬਾਰਾਂ ਸੌ ਸੀਗਾ ਤੇ ਵਿਨੋਦ ਚ ਸਲਿੱਪਰ ਦਾ ਲੋਗੇ ਉਹ ਪੰਦਰਾਂ ਸੌਲਾਂ ਸੌ ਰੁਪਏ ਚ ਪਏਗੀ ਹਾਂਜੀ ਉਹਦੇ ਵਿੱਚ ਤੁਹਾਨੂੰ ਦੋ ਟਾਈਮ ਦਾ ਖਾਣਾ ਮਿਲੇਗਾ ਨਾ ਮਤਲਬ ਦੋ ਟਾਈਮ ਮਿਲੇਗਾ ਹਾਂਜੀ ਜਿਵੇਂ ਜੇ ਤੁਸੀਂ ਰਾਤੇ ਚਲਦੇ ਹੋ ਤਾਂ ਰਾਤ ਦਾ ਡਿਨਰ ਵੀ ਮਿਲੇਗਾ ਤੇ ਸਵੇਰੇ ਤੱਕ ਤੁਹਾਨੂੰ ਬ੍ਰੇਕਫਾਸਟ ਚਾਹੇ ਵਗੈਰਾ ਵੀ ਅਵੇਲੇਬਲ ਹੋਏਗੀ ਹਾਂਜੀ ਟਾਈਮ ਤਾਂ ਲਗਭਗ ਸੇਮ ਹੀ ਲੱਗੇਗਾ ਹਾਂਜੀ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਆ ਕੇ ਵੀ ਮਤਲਬ ਸਾਰੇ ਫੋਰਮ ਵਗੈਰਾ ਫਿਲ ਕਰ ਲਿਆ ਜੇ ਹਾਂਜੀ ਪੇਮੈਂਟ ਆਨਲਾਈਨ ਕਰੋਗੇ ਜਾਂ ਕੈਸ਼ ਹੀ ਦੋਗੇ ਫਿਰ ਅੱਛਾ ਠੀਕ ਹੈ ਜੀ ਠੀਕ ਹੈ ਜੀ ਓਕੇ